ਚਿੱਤਰਕਾਰੀ ਇੱਕ ਬਹੁਤ ਵੱਡੀ ਕਲਾ ਹੈ ਜਿਸ ਦੇ ਵਿੱਚ ਅਸੀਂ ਆਪਣੇ ਪੋਸਟਰ ਰਾਹੀਂ ਚਿੱਤਰ ਬਣਾ ਕੇ ਆਪਣੇ ਜੋ ਆਪਣੀਆਂ ਭਾਵਨਾਵਾਂ ਨੂੰ ਕਿਸੇ ਦੂਸਰੇ ਦੇ ਅੱਗੇ ਪੇਸ਼ ਕਰਦੇ ਹਾਂ ਚਿੱਤਰਕਾਰੀ ਇਕ ਮਨੋਰੰਜਨ ਸਾਧਨ ਵੀ ਹੈ ਆਪਣੇ ਮਨ ਨੂੰ ਇਸ ਨਾਲ ਸ਼ਾਂਤੀ ਵੀ ਮਿਲਦੀ ਹੈ ਕਲਾ ਕਰਨ ਦੇ ਨਾਲ ਡਰਾਇੰਗ ਕਰਨ ਦੇ ਨਾਲ ਚਿੱਤਰਕਾਰੀ ਵਿੱਚ ਕਈ ਦਿਨ ਅਜਿਹੇ ਵੀ ਜੋ ਅਸੀਂ ਨਹੀਂ ਬਣਾਉਣਾ ਚਾਹੁੰਦੇ ਕਿ ਜਿਵੇਂ ਚਿੱਤਰਕਾਰੀ ਦੇ ਵਿੱਚ ਕਿਸੇ ਟਾਈਮ ਕਿਸੇ ਦੇਸ਼ ਵਿੱਚ ਜਾਂ ਕਿਸੇ ਕਸਬੇ ਵਿੱਚ ਕੋਈ ਚਾਲ ਵਗੈਰਾ ਦੇ ਨਾਲ ਕੋਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਵੇ ਅਤੇ ਅਸੀਂ ਉਸਨੂੰ ਚਿੱਤਰ ਰਾਹੀਂ ਦਰਸਾਉਣ ਵਿਚ ਸਾਡੇ ਮਤਲਬ ਮਨ ਨੂੰ ਇਹ ਚੰਗੀ ਗੱਲ ਨਹੀਂ ਲੱਗਦੀ ਕਿ ਚਿੱਤਰਕਾਰੀ ਆ ਉਹਦੇ ਵਿੱਚ ਮਤਲਬ ਕੁਝ ਅਜਿਹਾ ਹੀ ਬਣਾਇਆ ਜਾਵੇ ਕਿ ਜਿਸ ਨੂੰ ਵੇਖ ਕੇ ਕਿਸੇ ਦੇ ਮਨ ਨੂੰ ਖੁਸ਼ੀ ਮਹਿਸੂਸ ਹੋਵੇ ਕਿਸੇ ਦਾ ਮਨ ਮਹਿਕੇ ਕਿ ਬਹੁਤ ਅੱਛੀ ਜਾਂ ਕੋਈ ਕਰੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਚਿੱਤਰਕਾਰੀ ਦਾ ਪ੍ਰਬੰਧ ਅਸੀਂ ਆਪਣੇ ਮਤਲਬ ਛੋਟੇ ਪੋਸਟਰਾਂ ਦੇ ਉੱਪਰ ਰੰਗ ਵਗੈਰਾ ਲੈ ਕੇ ਜਾਂ ਆਪਣੇ ਪੈਲਟ ਵਗੈਰਾ ਕੁਛ ਵੀ ਬੋਰਡ ਵਗੈਰਾ ਲੈ ਕੇ ਅਸੀਂ ਚਿੱਤਰਕਾਰੀ ਕਰ ਸਕਦੇ ਹਾਂ ਬੱਚਿਆਂ ਵਿੱਚ ਵੀ ਚਿੱਤਰਕਾਰੀ ਦਾ ਬਹੁਤ ਮਤਲਬ ਕਰੇਜ ਹੈਗਾ ਆ ਬੱਚੇ ਡਰਾਇੰਗ ਕਰਨ ਦੇ ਨਾਲ ਆਪਣੇ ਆਪ ਨੂੰ ਰਿਲੈਕਸ ਫੀਲ ਕਰਦੇ ਹਨ